ਬੁਣਾਈ ਅਤੇ ਸਿਲਾਈ ਲਈ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਹੁੰਦੀਆਂ ਹਨ ਬਟ ਮੈਂ ਉਹਨਾਂ ਦੇ ਵਿੱਚੋਂ ਕੁੱਛ ਹੀ ਦੱਸੂੰਗੀ ਜਿਵੇਂ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਹਨ ਜਿਵੇਂ ਕਿ ਕਢਾਈ ਵਾਲੀ ਮਸ਼ੀਨ ਇੰਟਰਲੋਕ ਵਾਲੀ ਮਸ਼ੀਨ ਕੱਪੜਾ ਮਸ਼ੀਨ ਦਾ ਤੇਲ ਸੂਈ ਪੀਕੋ ਵਾਲੀ ਮਸ਼ੀਨ ਧਾਗਾ ਕੈਂਚੀ ਸੂਈ ਬਹੁਤ ਸਾਰੇ ਬਹੁਤ ਸਾਰੇ ਟੂਲਸ ਐਸੇ ਹੁੰਦੇ ਹਨ ਜੋ ਜੋ ਬੁਣਾਈ ਅਤੇ ਸਿਲਾਈ ਲਈ ਜ਼ਰੂਰ ਜਿਨਾਂ ਦੀ ਜ਼ਰੂਰਤ ਹੁੰਦੀ ਹੈ ਮੇਰੇ ਕੋਲ ਇਹਨਾਂ ਦੇ ਵਿੱਚੋਂ ਕਢਾਈ ਵਾਲੀ ਮਸ਼ੀਨ ਨਹੀਂ ਹੈ ਅਤੇ ਮੈਂ ਹੋਰ ਬਿਹਤਰ ਬਣਨ ਦੇ ਲਈ ਕਢਾਈ ਵਾਲੀ ਮਸ਼ੀਨ ਲੈਣਾ ਚਾਹੂੰਗੀ ਅਤੇ ਮੈਂ ਆਪਣਾ ਬੂਟੀਕ ਖੋਲ੍ਹਣਾ ਚਾਹੂੰਗੀ ਜਿਸ ਦੇ ਵਿੱਚ ਕਿ ਮੈਂ ਅਲੱਗ ਅਲੱਗ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੱਪੜੇ ਬਣਾਉਣਾ ਚਾਹੁੰਦੀ